ਹਸਪਤਾਲਾਂ ਪ੍ਰਬੰਧਾ ਬਾਰੇ ਜਿੰਨਾ ਕੁ ਮੈਂ ਜਾਣਦੀ ਹਾਂ ਸਾਡੇ ਦੇਸ਼ ਵਿੱਚ ਕਿਤੇ ਨਾ ਕਿਤੇ ਕਮੀ ਹੈ ਸਾਡੇ ਦੇਸ਼ ਵਿੱਚ ਹਸਪਤਾਲਾਂ ਦੇ ਦੋ ਵਰਗ ਹੈ ਇੱਕ ਤਾਂ ਸਰਕਾਰੀ ਵਰਗ ਅਤੇ ਦੂਜਾ ਪ੍ਰਾਈਵੇਟ ਵਰਗ ਪ੍ਰਾਈਵੇਟ ਵਰਗ ਦੇ ਵਿੱਚ ਸਭ ਕੁਛ ਏ ਵੰਨ ਮਿਲਦਾ ਹੈ ਬਟ ਉੱਥੇ ਪੈਸੇ ਦਾ ਜ਼ਿਆਦਾ ਮੋਲ ਹੈ ਅਤੇ ਸਰਕਾਰੀ ਵਰਗ ਦੇ ਵਿੱਚ ਵੀ ਸਾਨੂੰ ਸਭ ਕੁਝ ਮਿਲ ਸਕਦਾ ਹੈ ਪਰ ਉਹਦੇ ਸਮੇਂ ਦੀ ਕਟੋਤੀ ਹੈ ਗਰੀਬ ਸਰਕਾਰੀ ਵਰਗ ਦੇ ਵਿੱਚ ਜਾਂਦਾ ਹੈ ਸਮੇਂ ਦੇ ਕਮੀ ਕਮੀ ਕਾਰਨ ਉਹ ਕ ਕਈਆਂ ਨੂੰ ਆਪਣੀ ਜਾਨ ਗਵਾਉਣੀ ਪੈਂਦੀ ਹੈ ਅਤੇ ਪ੍ਰਾਈਵੇਟ ਵਰਗ ਦੇ ਵਿੱਚ ਜੇਕਰ ਗਰੀਬ ਚਲੇ ਵੀ ਜਾਂਦਾ ਹੈ ਅਤੇ ਕਿਤੇ ਨਾ ਕਿਤੇ ਹਸਪਤਾਲਾਂ ਦਾ ਖਰਚਾ ਹੀ ਇੰਨਾ ਹੋ ਜਾਂਦਾ ਹੈ ਕਿ ਉਹ ਉਸ ਉਸਦਾ ਬੋਝ ਸਹਿ ਨਹੀਂ ਸਹਿ ਨਹੀਂ ਪਾਂਦਾ ਅਤੇ ਕਾਫੀ ਜ਼ਿਆਦਾ ਕਰਜਿਆਂ ਵਿੱਚ ਡੁੱਬ ਜਾਂਦਾ ਹੈ ਮੈਨੂੰ ਇੰਝ ਲੱਗਦਾ ਹੈ ਕਿ ਸਭ ਕੁਝ ਕਿਤੇ ਨਾ ਕਿਤੇ ਪੂਰਾ ਹੈ ਪਰ ਕਿਤੇ ਨਾ ਕਿਤੇ ਅਧੂਰਾ ਵੀ ਹੈ